ਮੈਨੂੰ ਕੁਦਰਤ ਦੀਆਂ ਤਸਵੀਰਾਂ ਲੈਣਾ ਬਹੁਤ ਪਸੰਦ ਹੈ ਜੀ ਮੈਂ ਜ਼ਿਆਦਾਤਰ ਪੰਛੀ ਪੇੜ ਪੌਦੇ ਫ ਅਤੇ ਫੁੱਲਾਂ ਦੀਆਂ ਤਸਵੀਰਾਂ ਲੈਂਦੀ ਹਾਂ ਜਿੱਥੇ ਮੈਨੂੰ ਕੋਈ ਸੋਹਣਾ ਫੁੱਲ ਦਿਖ ਜਾਂਦਾ ਕਿਸੇ ਵੀ ਰੰਗ ਦਾ ਮੈਂ ਉਹਦੇ ਫੋਟੋ ਲੈ ਲੈਂਦੀ ਹਾਂ ਅਤੇ ਖ਼ਾਸ ਕਰਕੇ ਸ਼ਾਮ ਦੇ ਵੇਲੇ ਜਦੋਂ ਸੂਰਜ ਢਲਦਾ ਉਸ ਵੇਲੇ ਮੈਨੂੰ ਆਸਮਾਨ ਬਹੁਤ ਸੋਹਣਾ ਲੱਗਦਾ ਮੈਨੂੰ ਉਹਦੀਆਂ ਤਸਵੀਰਾਂ ਖਿੱਚਣਾ ਬਹੁਤ ਪਸੰਦ ਹੈ ਜਾਂ ਫਿਰ ਮੈਨੂੰ ਉਹ ਚੀਜ਼ਾਂ ਦੀਆਂ ਤਸਵੀਰਾਂ ਲੈਣੀਆਂ ਬੜੀਆਂ ਪਸੰਦ ਹਨ ਜੋ ਮੈਨੂੰ ਆਮ ਤੌਰ 'ਤੇ ਦੇਖਣ ਨੂੰ ਨਹੀਂ ਮਿਲਦੀਆਂ ਜੋ ਬੜੀਆਂ ਅਲੱਗ ਹੁੰਦੀਆਂ ਹੈ ਜਿਵੇਂ ਕਿਸੇ ਦੇ ਘਰ 'ਚ ਮੇਜ਼ 'ਤੇ ਵਿਛਿਆ ਹੋਇਆ ਕਰੋਸ਼ੀਆ ਦਾ ਕਾਰਪੈਟ ਜਾਂ ਸਾਈਡ 'ਤੇ ਪਿਆ ਹੋਇਆ ਲੈਂਪ ਮੈਨੂੰ ਬਹੁਤ ਆਕਰਸ਼ਿਤ ਕਰਦਾ ਹੈ ਤਾਂ ਪੁਰਾਣੇ ਘਰ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਮੈਨੂੰ ਉਹਨਾਂ ਦੀਆਂ ਫੋ ਫੋਟੋਆਂ ਲੈਣਾ ਬਹੁਤ ਪਸੰਦ ਹੈ ਅਤੇ ਮੈਨੂੰ ਹੱਸਦੇ ਹੋਏ ਚਿਹਰੇ ਬਹੁਤ ਪਸੰਦ ਹਨ ਕੋਈ ਮਾਸੂਮ ਜਿਹਾ ਬੱਚਾ ਮੈਨੂੰ ਦਿਖ ਜਾਂਦਾ ਤਾਂ ਮੈਂ ਉਹਦੀ ਫੋਟੋ ਲੈ ਲੈਂਦੀ ਹਾਂ